ਮੇਰੇ ਅਨੁਸਾਰ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਪਿਛਲੇ ਕੁਛ ਸਾਲਾਂ ਤੋਂ ਬਹੁਤ ਜ਼ਿਆਦਾ ਯਤਨ ਕੀਤੇ ਹਨ ਜੋ ਕਿ ਸਫਲ ਰਹੇ ਹਨ ਅਤੇ ਜਿਨ੍ਹਾਂ ਦਾ ਪ੍ਰਭਾਵ ਅਸੀਂ ਆਪਣੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਦੇਖ ਸਕਦੇ ਹਾਂ ਅਤੇ ਇਸ ਦੀ ਇੱਕ ਉਦਾਹਰਨ ਮੇਰੇ ਪਿੰਡ ਦੀ ਹੈ ਪਿਛਲੇ ਵਰ੍ਹਿਆਂ ਵਿੱਚ ਲੋਕਾਂ ਨੂੰ ਪੜ੍ਹਾਈ ਲਈ ਲਗਭਗ ਦਸ ਕਿਲੋਮੀਟਰ ਦੂਰ ਆਪਣੇ ਪੰਜ ਤੋਂ ਸੱਤ ਸਾਲਾਂ ਦੇ ਬੱਚੇ ਨੂੰ ਭੇਜਣਾ ਪੈਂਦਾ ਸੀ ਅਤੇ ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਲੋਕ ਇਸ ਤੋਂ ਵਾਂਝੇ ਰਹਿ ਜਾਂਦੇ ਸਨ ਪਰ ਪਿਛਲੀਆਂ ਸਰਕਾਰਾਂ ਨੇ ਇਸ ਲਈ ਕੁਝ ਲਈ ਨਾ ਕੀਤਾ ਪਰ ਪਿਛਲੇ ਕੁਛ ਵੀਹ ਸਾਲਾਂ ਤੋਂ ਸਾਡੇ ਪਿੰਡ ਦੇ ਵਿੱਚ ਇੱਕ ਸਕੂਲ ਜੋ ਕਿ ਪਹਿਲਾਂ ਪੰਜਵੀਂ ਤੱਕ ਸੀ ਹੁਣ ਲਗਭਗ ਪਲੱਸ ਟੂ ਤੱਕ ਹੋ ਗਿਆ ਹੈ ਅਤੇ ਲੋਕ ਜਿੱਥੇ ਜਾ ਕੇ ਆਪਣੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਕਰਾ ਸਕਦੇ ਹਨ ਇਸ ਦੇ ਨਾਲ ਨਾਲ ਉੱਥੇ ਇੱਕ ਖੇਡਾਂ ਲਈ ਮੈਦਾਨ ਵੀ ਬਣ ਗਿਆ ਹੈ ਮੇਰੇ ਅਨੁਸਾਰ